ਬਾਈ ਸਤੰਬਰ ਉੱਨੀ ਸੌ ਨੜੇਨਵੇਂ ਵੀਹ ਸਤੰਬਰ ਦੋ ਹਜ਼ਾਰ ਵੀਹ ਇੱਕ ਜਨਵਰੀ ਦੋ ਹਜ਼ਾਰ ਤਿੰਨ ਛੱਬੀ ਦਸੰਬਰ ਦੋ ਹਜ਼ਾਰ ਚੌਦ੍ਹਾਂ ਪੰਦਰ੍ਹਾਂ ਨਵੰਬਰ ਦੋ ਹਜ਼ਾਰ ਦੋ